ਯੋਗਾ ਦੇ ਸਿਧਾਂਤਾਂ ਨੂੰ ਮਹਿਕ ਤੋਂ ਬਾਹਰ ਰੋਜ਼ਾਨਾ ਜੀਵਨ ਵਿੱਚ ਅਸੀਂ ਇਸ ਤਰ੍ਹਾਂ ਲਾਗੂ ਕਰ ਸਕਦੇ ਹਾਂ ਕਿ ਜਿਸ ਤਰ੍ਹਾਂ ਸਵੇਰੇ ਹਰੀ ਘਾਸ 'ਤੇ ਬੈਠ ਕੇ ਜਾਂ ਘੁੰਮ ਫਿਰ ਕੇ ਅਸੀਂ ਆਪਣੇ ਪੈਰਾਂ ਦੀਆਂ ਤਲੀਆਂ ਨੂੰ ਠੰਡਕ ਪਹੁੰਚਾਉਣ ਲਈ ਅਸੀਂ ਜਿੱਦਾਂ ਗਰਾਊਂਡ ਵਿੱਚ ਜਾ ਕੇ ਅਤੇ ਅਸੀਂ ਮੈਟ ਤੋਂ ਬਗੈਰ ਵੀ ਅਸੀਂ ਯੋਗਾ ਕਰ ਸਕਦੇ ਹਾਂ ਖੜ੍ਹੇ ਹੋ ਕੇ ਮਤਲਬ ਕਿ ਬਾਹਾਂ 'ਤੇ ਲੱਤਾਂ ਨੂੰ ਵਰਜਿਸ਼ ਦੀ ਤਰ੍ਹਾਂ ਇਸਤੇਮਾਲ ਕਰਕੇ ਵੀ ਅਸੀਂ ਯੋਗਾ ਕਰ ਸਕਦੇ ਹਾਂ ਅਤੇ ਸਵੇਰ ਦੇ ਟਾਈਮ ਵਿੱਚ ਯੋਗਾ ਕਰਨਾ ਸਭ ਤੋਂ ਵਧੀਆ ਹੈ ਅਤੇ ਮੈਟ ਤੋਂ ਬਾਹਰ ਜਿਸ ਤਰ੍ਹਾਂ ਮੈਟ 'ਤੇ ਇਸ ਲਈਏ ਕੀ ਕਰਦੇ ਹਾਂ ਕਿ ਜਿੱਦਾਂ ਜ਼ਮੀਨ ਸਹੀ ਨਹੀਂ ਹੁੰਦੀ ਸਾਫ਼ ਸੁਥਰੀ ਨਹੀਂ ਕਿਸੇ ਟਾਈਮ ਹੁੰਦੀ ਤੋ ਐਸੇ ਮੈਟ ਤੋਂ ਬਿਨਾਂ ਜੋ ਹਰੀਆਂ ਗਰਾਉਂਡਾ ਵਿੱਚ ਜਾ ਕੇ ਵਧੀਆ ਯੋਗਾ ਹੋ ਜਾਂਦਾ ਹੈ ਇਸ ਕਰਕੇ ਸਵੇਰ ਦੇ ਟਾਈਮ ਘੁੰਮ ਫਿਰ ਕੇ ਕਰਨਾ ਯੋਗਾ ਮਤਲਬ ਕਿ ਹਵਾ ਵੀ ਤਾਜ਼ੀ ਸਾਡੇ ਅੰਦਰ ਜਾਂਦੀ ਹੈ ਅਤੇ ਇਸ ਲਈ ਸਵੇਰ ਦੇ ਟਾਈਮ ਯੋਗਾ ਕਰਨਾ ਬਹੁਤ ਵਧੀਆ ਗਿਣਿਆ ਜਾਂਦਾ ਹੈ ਮੈਟ ਤੋਂ ਬਿਨਾਂ